ਮੇਰਾ ਮਨਪਸਿੰਦਾ ਗਾਇਕ ਕਿਸ਼ੋਰ ਕੁਮਾਰ ਹੈ ਜਿਸਦੇ ਗਾਣੇ ਮੈਂ ਬਹੁਤ ਪਸੰਦ ਕਰਦਾ ਹਾਂ ਜਿਵੇਂ ਕਿ ਜ਼ਿੰਦਗੀ ਕੇ ਸਫਰ ਮੇ ਗੁਜ਼ਰ ਜਾਤੇ ਹੈ ਜੋ ਮੁਕਾਮ ਵੋ ਫਿਰ ਨਹੀਂ ਆਤੇ ਵੋ ਫਿਰ ਨਹੀਂ ਆਤੇ ਔਰ ਜ਼ਿੰਦਗੀ ਦਾ ਸਫਰ ਕੈਸਾ ਹੈ ਸਫਰ ਕੋਈ ਸਮਝਾ ਨਹੀਂ ਕੋਈ ਜਾਣਾ ਨਹੀਂ ਇਹ ਮੈਂ ਗਾਣੇ ਦੋ ਬਹੁਤ ਪਸੰਦ ਕਰਦਾ ਹਾਂ ਇਸ ਦੀਆਂ ਪਹਿਲਾਂ ਮੈਂ ਆਡੀਓ ਕੈਸਟ ਤੋਂ ਸੁਣਦਾ ਹੁੰਦਾ ਸੀ ਹੁਣ ਜਦ ਕਿ ਆਪਣਾ ਵੀਡੀਓ ਕੈਸਟ ਆਗੀਆਂ ਹਨ ਅਤੇ ਮੈਂ ਮੈਂ ਯੂਟਿਊਬ 'ਤੇ ਆਪਣਾ ਇਹ ਗਾਣੇ ਸੁਣਦਾ ਹਾਂ ਅਤੇ ਆਨੰਦ ਲੈਂਦਾ ਹਾਂ